ਪੰਜਾਬੀ ਸੱਭਿਆਚਾਰ ਵਿੱਚ ਭੰਗੜੇ ਦੀ ਇੱਕ ਬਹੁਤ ਵੱਡੀ ਮਹੱਤਵਤਾ ਹੈ ਇਹ ਹਰ ਖੁਸ਼ੀ ਦੇ ਸਮੇਂ ਮੁੰਡਿਆਂ ਨਾਲ ਪਾਇਆ ਜਾਂਦਾ ਹੈ ਇਹ ਇੱਕ ਲੋਕ ਨਾਚ ਹੈਗਾ ਹੈ ਅਤੇ ਇਹ ਸਮੇਂ ਦੇ ਨਾਲ ਨਾਲ ਹਰ ਤਿਉਹਾਰ ਵਿੱਚ ਅਪਣਾਇਆ ਜਾਂਦਾ ਹੈ ਇਹਦੇ ਵਿੱਚ ਮੁੰਡੇ ਰਲ ਮਿਲ ਕੇ ਇੱਕ ਗਾਣੇ ਉੱਤੇ ਭੰਗੜਾ ਪਾਉਂਦੇ ਹਨ ਅਤੇ ਖੁਸ਼ੀ ਮਨਾਉਂਦੇ ਹਨ